ਮੈਂ ਵੈਸੇ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਜਿਹੜੀ ਸਭ ਤੋਂ ਬੜੀ ਚੁਣੌਤੀ ਦਾ ਸਾਹਮਣਾ ਸੀ ਉਹ ਮੁੰਬਈ ਦੇ ਵਿੱਚ ਕੈਬਜੈਮਨੀ ਦੀ ਪਹਿਲੀ ਸਭ ਤੋਂ ਬੜੀ ਟ੍ਰਾਜੈਕਸ਼ਨ ਨੂੰ ਹੈਂਡਲ ਕਰਨਾ ਸੀ